ਪੰਜਾਬ ਵਿੱਚ ਹਰੇਕ ਧਰਮ ਦੇ ਲੋਕ ਆਪਣੇ ਧਾਰਮਿਕ ਪਰੰਪਰਾਵਾਂ ਮਾਂ ਦਾ ਪਾਲਣ ਕਰਦੇ ਹਨ ਅਤੇ ਆਪਣੇ ਜੋ ਪੁਰਾਣੇ ਰੀਤੀ ਰਿਵਾਜ਼ ਜੋ ਉਹਨਾਂ ਦੇ ਧਰਮ ਵਿੱਚ ਰੀਤੀ ਰਿਵਾਜ਼ ਅਤੇ ਰਸਮਾਂ ਹਨ ਉਹਨਾਂ ਦਾ ਪੂਰਾ ਪਾਲਣ ਕਰਦੇ ਹਨ ਹਿੰਦੂ ਧਰਮ ਦੇ ਲੋਕ ਆਪਣੇ ਧਰਮ ਲਈ ਪੂਰਾ ਅਤੇ ਮੁਸਲਿਮ ਧਰਮ ਦੇ ਲੋਕ ਆਪਣੇ ਧਰਮ ਦੀਆਂ ਪੂਰੀਆਂ ਰਸਮਾਂ ਨਿਭਾਉਂਦੇ ਹਨ ਜਿਵੇਂ ਕਿ ਹਿੰਦੂ ਧਰਮ ਦੇ ਲੋਕ ਤੀਰਥ ਸਥਾਨਾਂ 'ਤੇ ਜਾਣਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਮੁਸਲਿਮ ਧਰਮ ਦੇ ਲੋਕ ਮੁਸਲਿਮ ਥਾਵਾਂ 'ਤੇ ਜਾਣਾ ਪਸੰਦ ਕਰਦੇ ਹਨ ਅਤੇ ਸਿੱਖ ਧਰਮ ਦੇ ਲੋਕ ਸਿੱਖ ਨਾਲ ਸੰਬੰਧਿਤ ਕਈ ਸਥਾਵਾਂ 'ਤੇ ਜਾਣਾ ਅਤੇ ਗੁਰਦੁਆਰਿਆਂ ਵਿੱਚ ਜਾਣਾ ਪਸੰਦ ਕਰਦੇ ਹਨ ਅਤੇ ਇਸੇ ਲਈ ਹਰੇਕ ਧਰਮ ਦੇ ਲੋਕ ਆਪਣੇ ਧਰਮ ਨਾਲ ਸ ਰਿਲੇਟਡ ਰਸਮਾਂ ਰੀਤੀ ਰਿਵਾਜਾਂ ਨੂੰ ਨਿਭਾਉਣਾ ਪਸੰਦ ਕਰਦੇ ਹਨ